ਫੋਟੋ ਖਿੱਚਣ ਲਈ ਅਸੀਂ ਕੈਨੋਨ ਦੇ ਕੈਮਰੇ ਵਰਤਦੇ ਹਾਂ ਅੱਸੀ ਡੀ ਕੈਮਰਾ ਹੈ ਔਰ ਬੜੀ ਅੱਛੀ ਕੋਆਲਟੀ ਦੀ ਪਿਕਚਰ ਦਿੰਦਾ ਹੈ ਇਹ ਅਸੀਂ ਵਰਤਦੇ ਹਾਂ